ਭਾਰਤ ਦੀਆਂ ਬਹੁਤ ਸਾਰੀਆਂ ਖੇਡਾਂ ਜੋ ਇੰਤਰਨੈਸ਼ਨਲੀ ਬਹੁਤ ਜ਼ਿਆਦਾ ਮਾਨਤਾਯੋਗ ਹਨ ਪਰ ਉਹਨਾਂ ਨੂੰ ਉਹ ਮਾਨਤਾ ਪ੍ਰਾਪਤ ਨਹੀਂ ਹੋਈ ਹੈ ਜਿਵੇਂ ਕਿ ਬਹੁਤ ਸਾਰੀਆਂ ਖੇਡਾਂ ਹਨ ਜਿਵੇਂ ਕਬੱਡੀ ਹੋ ਗਈ ਗੱਤਕਾਂ ਇਹ ਭਲਵਾਨੀ ਹੋ ਗਈ ਇਹ ਸਾਡੇ ਛਿੰਝਾਂ 'ਚ ਜੋ ਵੀ ਕਰਵਾਈਆਂ ਜਾਂਦੀਆਂ ਹਨ ਇਹ ਸਾਡੇ ਬਹੁਤ ਜ਼ਿਆਦਾ ਗੱਤਕਾਂ ਇੱਕ ਇੱਕ ਬਹੁਤ ਜ਼ਿਆਦਾ ਮੁੱਖ ਵੱਡੀ ਸਪੋਰਟਸ ਹੈ ਜਿਸ ਨੂੰ ਸਾਨੂੰ ਇੰਟਰਨੈਸ਼ਨਲ ਰੂਪ 'ਤੇ ਆਪਣੀ ਇਹਨਾਂ ਨੂੰ ਬਹੁਤ ਜ਼ਿਆਦਾ ਮਾਨਤਾ ਦੀ ਲੋੜ ਹੈ ਪ੍ਰਾਪਤ ਕਰਨ ਦੀ ਬਹੁਤ ਜ਼ਿਆਦਾ ਜਰੂਰਤ ਹੈ ਸਾਡੀ ਕਬੱਡੀ ਵੀ ਸਾਡੀ ਇੰਡੀਆ ਦੀ ਬਹੁਤ ਵੱਡੀ ਪੰਜਾਬ ਸਟਾਇਲ ਕਬੱਡੀ ਬਹੁਤ ਬੜੀ ਗੇਮ ਹੈ ਜਿਸ ਨੂੰ ਬਾਹਰਲੇ ਲੋਕ ਵੀ ਬਹੁਤ ਜ਼ਿਆਦਾ ਪਸੰਦ ਕਰਦੇ ਹਨ ਪਰ ਉਸ ਨੂੰ ਇਸ ਲੈਵਲ ਤੱਕ ਦਾ ਮੁਕਾਮ ਨਹੀਂ ਮਿਲਿਆ ਜੀ ਉਸ ਨੂੰ ਮਾਨਤਾ ਪ੍ਰਾਪਤ ਕੀਤਾ ਜਾਵੇ ਇਸ ਲਈ ਸਾਨੂੰ ਪੰਜਾਬ ਪੰਜਾਬੀ ਕਬੱਡੀ ਜਿਹੋ ਜਿਹੀਆਂ ਇੱਦਾਂ ਦੀਆਂ ਬਹੁਤ ਸਾਰੀਆਂ ਗੇਮਾਂ ਗੇਮਾਂ ਨੂੰ ਸਾਡੇ ਭਾਰਤ ਨੂੰ ਬਹੁਤ ਜ਼ਿਆਦਾ ਮਾਨਤਾ ਪ੍ਰਾਪਤ ਦੇਣ ਦੀ ਲੋੜ ਹੈ ਅਤੇ ਉਹਨਾਂ ਵੱਲ ਧਿਆਨ ਦੇਣ ਦੀ ਲੋੜ ਹੈ ਜਿਸ ਨਾਲ ਸਾਡੀ ਬਹੁਤ ਜ਼ਿਆਦਾ ਖੇਡਾਂ ਨੂੰ ਮਾਨਤਾ ਪ੍ਰਾਪਤ ਹੋਈ ਜਾਂ ਦਿੱਤੀ ਜਾ ਸਕੇ ਅਤੇ ਸਾਡੀ ਖੇਡ ਬ ਅੱਗੇ ਵਧ ਸਕਣ ਸਾਡੇ ਖੇਤਰ